ਜਿਵੇਂ ਕਿ ਤੁਸੀਂ ਮੈਨੂੰ ਪੁੱਛਿਆ ਹੈ ਦਸ ਤੋਂ ਦਸ ਲੱਖ ਦੇ ਵਿਚਕਾਰ ਪੰਜ ਨੰਬਰ ਉਹ ਹਨ ਸੌ ਇੱਕ ਹਜ਼ਾਰ ਦੋ ਹਜ਼ਾਰ ਪੰਜ ਹਜ਼ਾਰ ਅਤੇ ਇਕ ਲੱਖ